ਪੰਦਰਾਂ ਅਗਸਤ ਉੱਨੀ ਸੌ ਉਣੰਜਾ ਸੋਲ੍ਹਾਂ ਫਰਵਰੀ ਉੱਨੀ ਸੌ ਚੁਰਾਨਵੇਂ ਤੇਰਾਂ ਅਪ੍ਰੈਲ ਦੋ ਹਜ਼ਾਰ ਸੋਲ੍ਹਾਂ ਛੱਬੀ ਗਿਆਰਾਂ ਉੱਨੀ ਸੌ ਪਚਾਨਵੇਂ ਚਾਰ ਅਕਤੂਬਰ ਦੋ ਹਜ਼ਾਰ ਤਿੰਨ